ਪਿੰਡਾਂ ਦੇ ਵਿੱਚ ਵਾਤਾਵਰਨ ਦੀ ਸੁਰੱਖਿਆ ਲਈ ਬਹੁਤ ਸਾਰੇ ਕੁਦਮ ਕਦਮ ਚੁੱਕੇ ਜਾਂਦੇ ਹਨ ਜਿੱਦਾਂ ਕਿ ਪਿੰਡ ਦੇ ਸਰਪੰਚ ਅਤੇ ਪੰਚ ਮਿਲ ਕੇ ਮਨਰੇਗਾ ਵਾਲੇ ਵਿਅਕਤੀਆਂ ਤੋਂ ਪੇੜ ਪੌਦੇ ਲਗਵਾ ਪਿੰਡਾਂ ਵਿੱਚ ਲਗਵਾਉਂਦੇ ਹਨ ਅਤੇ ਉਹਨਾਂ ਨੂੰ ਟਾਈਮ ਟੂ ਟਾਈਮ ਪਾਣੀ ਖਾਦ ਵੀ ਦਿੱਤੀ ਜਾਂਦੀ ਹੈ ਤਾਂ ਜੋ ਉਹ ਸਹੀ ਤਰੀਕੇ ਨਾਲ ਫਲ ਅਤੇ ਫੁੱਲ ਸਕਣ ਇਸ ਤੋਂ ਇਲਾਵਾ ਪਿੰਡ ਵਿੱਚ ਪੰਚਾਂ ਸਰਪੰਚਾਂ ਨੇ ਮਿਲ ਕੇ ਖੁਦ ਆਪਣੇ ਹੱਥੀਂ ਕਈ ਸਫਾਈ ਕਰਮਚਾਰੀ ਰਖਵਾਏ ਗਏ ਹਨ ਜੋ ਕਿ ਪਿੰਡ ਦੀ ਸਫਾਈ ਈ ਨੂੰ ਬਰਕਰਾਰ ਰੱਖਦੇ ਹਨ ਅਤੇ ਪਿੰਡ ਦੇ ਸਰਪੰਚਾਂ ਨੇ ਕੂੜੇਦਾਨ ਵੀ ਹਰ ਮਹੱਲੇ ਬੀਹੀ ਵਿੱਚ ਰਖਵਾਏ ਗਏ ਹਨ ਅਤੇ ਇਸ ਦੇ ਵਿੱਚ ਗਿੱਲੇ ਗਿੱਲਾ ਕੂੜਾ ਅਤੇ ਸੁੱਕਾ ਕੂੜੇ ਦੇ ਅਲੱਗ ਅਲੱਗ ਡਸਟਬਿਨ ਵੀ ਹਨ ਤਾਂ ਜੋ ਗਿੱਲੇ ਕੂੜੇ ਕੀ ਖਾਦ ਬਣਾਈ ਜਾ ਸਕੇ ਅਤੇ ਸੁੱਕੇ ਕੂੜੇ ਨੂੰ ਉਸਦੀ ਜਗ੍ਹਾ 'ਤੇ ਸਹੀ ਢੰਗ ਨਾਲ ਯੂਜ ਕੀਤਾ ਜਾ ਸਕੇ ਇਸ ਤੋਂ ਇਲਾਵਾ ਪਿੰਡ ਦੇ ਪੰਚ ਸਰਪੰਚ ਮਿਲ ਕੇ ਪਿੰਡ ਦੀ ਸਫਾਈ ਦੇ ਵਿੱਚ ਬਹੁਤ ਹੀ ਅਹਿਮ ਯੋਗਦਾਨ ਪਾਉਂਦੇ ਹਨ ਅਤੇ ਪਾਣੀ ਦੀ ਸਪਲਾਈ ਲਈ ਹੀ ਵੀ ਕੁਛ ਸਖਤ ਨਿਯਮ ਬਣੇ ਗ ਬਣਾਏ ਗਏ ਹਨ ਜਿੱਦਾਂ ਕਿ ਜੇਕਰ ਕੋਈ ਵਿਅਕਤੀ ਲਾਪਰਵਾਹੀ ਕਰਦਾ ਹੈ ਪਾਣੀ ਜ਼ਿਆਦਾ ਮਾਤਰਾ ਵਿੱਚ ਵੇਸਟ ਕਰਦਾ ਹੈ ਤਾਂ ਉਸਨੂੰ ਪਨਿਸ਼ਮੈਂਟ ਦੇਣਾ ਜਾਂ ਉਹਨਾਂ ਤੋਂ ਜੁਰਮਾਨਾ ਵੀ ਲੈਂਦੇ ਹਨ ਇਹੋ ਜਿਹੀਆਂ ਚੀਜ਼ਾਂ ਸਾਡੇ ਪਿੰਜ ਪਿੰਡ ਵਿੱਚ ਆਮ ਹਨ ਤੇ ਇਸ ਨਾਲ ਸਾਡੇ ਪਿੰਡ ਵਿੱਚ ਬਹੁਤ ਹੀ ਜ਼ਿਆਦਾ ਸਫਾਈ ਰਹਿੰਦੀ ਹੈ